ਨੌ ਸੱਤ ਛੇ ਤਿੰਨ ਛੇ ਸੱਤ ਦੋ ਇੱਕ ਪੰਜ ਚਾਰ ਅੱਠ ਦੋ ਨੌ ਸਿਫ਼ਰ ਸਿਫ਼ਰ ਅੱਠ ਦੋ ਇੱਕ ਸੱਤ ਛੇ